ਹਾਂ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਾਈਬ੍ਰੇਰੀਆਂ ਹੈ ਜਿਹੜੀਆਂ ਕਿ ਸਾਨੂੰ ਦੇਖਣ ਦਾ ਮੌਕਾ ਮਿਲਦਾ ਹੈ ਅਤੇ ਇਸ ਤਰ੍ਹਾਂ ਮੈਨੂੰ ਪੜ੍ਹਨ ਦਾ ਸ਼ੌਕ ਹੋਣ ਕਰਕੇ ਮੈਂ ਆਪਣੇ ਘਰ ਦੇ ਵਿੱਚ ਵੀ ਛੋਟੀ ਜਿਹੀ ਜਿਹੜੀ ਇੱਕ ਲਾਈਬ੍ਰੇਰੀ ਟੈਪ ਬਣਾਈ ਹੋਈ ਹੈ ਕਿਉਂਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਅਤੇ ਇਸ ਕਰਕੇ ਮੈਂ ਚਾਹੁੰਦਾ ਵੀ ਹਾਂ ਅਤੇ ਮੇਰੇ ਪਿੰਡ ਵਿੱਚ ਵੀ ਲਾਈਬ੍ਰੇਰੀ ਨਹੀਂ ਹੈ ਅਤੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਉਹ ਲਾਈਬ੍ਰੇਰੀ ਹੈ ਉੱਥੇ ਜਾ ਕੇ ਸਾਨੂੰ ਜਿਹੜੀ ਕਿਤਾਬਾਂ ਆ ਉਹ ਆਪਣੇ ਪਸੰਦ ਦੀਆਂ ਲੈ ਕੇ ਪੜ੍ਹਦੇ ਹਾਂ ਅਤੇ ਉੱਥੇ ਜਾ ਕੇ ਵੀ ਪੜ੍ਹਦੇ ਹਾਂ ਅਤੇ ਮੈਂ ਚਾਹੁੰਦਾ ਹਾਂ ਪ ਹੋਰ ਵੀ ਜੇ ਮੈਨੂੰ ਸ ਮੇਰੇ ਸੁਪਨਾ ਵੀ ਹੈ ਵੀ ਮੇਰੇ ਸ਼ਹਿਰ ਦੇ ਵਿੱਚ ਇੱਕ ਵਧੀਆ ਲਾਇਬ੍ਰੇਰੀ ਹੋਵੇ ਜਿੱਥੇ ਕਿ ਹਰ ਤਰ੍ਹਾਂ ਦੀ ਕਿਤਾਬ ਹੋਵੇ ਅਤੇ ਮੇਰੇ ਸ਼ਹਿਰ ਦੇ ਲੋਕ ਮੇਰੇ ਇਲਾਕੇ ਦੇ ਲੋਕ ਮੇਰੇ ਸਕੇ ਸੰਬੰਧੀ ਦੋਸਤ ਵੀ ਕਿਤਾਬਾਂ ਪੜ੍ਹਨ ਕਿਉਂਕਿ ਜਿਹੜੀ ਲਾਈਬ੍ਰੇਰੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਇਹਦਾ ਅਹਿਮ ਰੋਲ ਹੁੰਦਾ ਆ ਅਤੇ ਕਿਤਾਬਾਂ ਅਤੇ ਲਾਈਬ੍ਰੇਰੀ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਦਿੰਦੀਆਂ ਨੇ ਜ਼ਿੰਦਗੀ ਖੁਸ਼ਹਾਲ ਕਰਦੀਆਂ ਨੇ